ਖੇਡਾਂ ਦੇ ਵਿੱਚ ਨਸ ਨਸਲੀ ਭੇਦ ਭਾਵ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਨਸਲੀ ਭੇਦ ਭਾਵ ਕਰਨ ਨਾਲ ਸਾਡੇ ਉਹ ਖਿਡਾਰੀ ਜਿਹੜੇ ਵਧੀਆ ਤਰੀਕੇ ਨਾਲ ਖੇਡਦੇ ਆ ਉਹਨਾਂ ਦੇ ਵਿੱਚ ਭੇਦ ਭਾਵ ਦੀ ਭਾਵਨਾ ਆਉਂਦੀ ਹੈ ਇਸ ਕਰਕੇ ਉਹਨਾਂ 'ਤੇ ਇਹ ਪ੍ਰਭਾਵ ਨਹੀਂ ਹੋਣਾ ਚਾਹੀਦਾ ਕਿ ਉਹ ਉਸ ਦਾ ਧਰਮ ਹੋਰ ਆ ਜਾਂ ਉਹ ਕਾਲਾ ਆ ਜਾਂ ਗੋਰਾ ਆ ਉਹਦੀ ਕਾਬਲੀਅਤ ਦੇਖਣੀ ਚਾਹੀਦੀ ਆ ਕਿ ਉਹ ਅਗਰ ਉਹ ਕਾਬਲ ਆ ਤਾਂ ਉਹਨੂੰ ਸਫਲਤਾ ਮਿਲਣੀ ਚਾਹੀਦੀ ਹੈ ਇਸ ਲਈ ਔਰਤਾਂ ਵੀ ਅਗਰ ਨੁਮਾਇੰਦਗੀ ਕਰਨਾ ਚਾਹੁੰਦੀਆਂ ਤਾਂ ਉਹ ਕਿਸੇ ਵੀ ਖੇਤਰ ਵਿੱਚ ਨੁਮਾਇੰਦਗੀ ਕਰ ਸਕਦੀਆਂ ਹਨ ਕਿਉਂਕਿ ਉਹਨਾਂ ਵਿੱਚ ਯੋਗ ਹੋਣਾ ਚਾਹੀਦਾ ਆ ਅਗਰ ਉਹ ਇਹ ਕਰ ਸਕਦੀਆਂ ਆ ਕਿਸੇ ਵੀ ਨੁਮਾਇੰਦਗੀ ਕਰ ਸਕਦੀਆਂ ਤਾਂ ਉਹਨਾਂ ਨੂੰ ਜ਼ਰੂਰ ਨੁਮਾਇੰਦਗੀ ਦੇਣੀ ਚਾਹੀਦੀ ਆ ਚਾਹੇ ਉਹ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਵੇ ਚਾਹੇ ਉਹ ਕਿਸੇ ਫੈਕਟਰੀ ਦੀ ਮਾਲਕ ਹੋਵੇ ਉਹ ਕਿਸੇ ਵੀ ਖੇਤਰ ਵਿੱਚ ਜਾ ਸਕਦੀਆਂ ਔਰਤਾਂ ਕੁਝ ਵੀ ਕਰ ਸਕਦੀਆਂ ਆ ਉਨ੍ਹਾਂ ਦੇ ਵਿਚਾਰ ਉਨ੍ਹਾਂ ਦੀਆਂ ਸਫਲਤਾਵਾਂ ਉਨ੍ਹਾਂ ਦੀਆਂ ਚੁਣੌਤੀਆਂ ਉਨ੍ਹਾਂ ਦੇ ਅੱਗੇ ਆਉਂਦੀਆਂ ਹਨ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਨੂੰ ਨੁਮਾਇੰਦਗੀ ਦੇਣੀ ਚਾਹੀਦੀ ਆ ਅਗਰ ਉਹਦੇ ਵਿੱਚ ਕਾਬਲੀਅਤ ਆ ਹੈਗੀ ਆ ਤਾਂ